ਸਤਿ ਸ਼੍ਰੀ ਅਕਾਲ ਸਰ ਹੋਰ ਦੱਸੋ ਕਿਵੇਂ ਹੋ ਹਾਂਜੀ ਸਰ ਸਭ ਚੰਗਾ ਤੁਸੀਂ ਦੱਸੋ ਓਕੇ ਸਰ ਬਹੁਤ ਸ਼ੁਕਰੀਆ ਸਰ ਹਾਂਜੀ ਹਾਂਜੀ ਠੀਕ ਆ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਗੇਮ ਲਈ ਤਾਂ ਪੁੱਛਣਾ

ਓਕੇ ਸਰ ਸਰ ਕਿੰਨੀਆਂ ਫੋਟੋ ਕਾਪੀਆਂ ਚਾਹੀਦੀਆਂ ਆਪਾਂ ਨੂੰ ਠੀਕ ਹੈ ਸਰ ਹਾਂਜੀ ਹਾਂਜੀ ਓਕੇ ਜੀ ਸਰ ਠੀਕ ਹੈ ਠੀਕ ਹੈ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਸਰ ਇਹ ਤਾਂ ਹੈ ਹਾਂਜੀ ਹਾਂਜੀ

ਠੀਕ ਹੈ ਸਰ ਹਾਂਜੀ ਹਾਂਜੀ ਓਕੇ ਸਰ ਕੀ ਕੀ ਲੈਣਾ ਜਿਵੇਂ ਤੁਸੀਂ ਦੱਸ ਦਿਓ ਥੋੜ੍ਹਾ ਜਿਹਾ ਸਵੇਰੇ ਕੀ ਖਾਣਾ ਹਾਂਜੀ ਹਾਂਜੀ

ਠੀਕ ਹੈ ਸਰ ਹਾਂਜੀ ਹਾਂਜੀ ਠੀਕ ਹੈ ਸਰ ਜਿਵੇਂ ਆ ਜਿਹੜੀ ਕਹਿੰਦੇ ਪਏ ਹੋ ਮੈਨੂੰ ਇਹ ਫਿਰ ਕੌਲੇਜ ਹੀ ਦੇਵੇਗੀ ਮੈਨੂੰ ਜੋ ਜੀ ਤੁਸੀਂ ਕਹਿੰਦੇ ਪਏ ਕੌਲੇਜ ਹੀ ਪ੍ਰੋਵਾਈਡ ਕਰੇਗੀ ਹਾਂਜੀ ਸਰ ਹਾਂਜੀ ਹਾਂਜੀ ਸਰ ਇਹ ਤਾਂ ਤੁਸੀਂ ਕਹਿ ਰਹੇ ਹੋ

ਠੀਕ ਆ ਸਰ ਠੀਕ ਹੈ ਸਰ ਇਹਦਾ ਕੀ ਸਪੈਸਫਿਕ ਡੇਟ ਕਦੋਂ ਤੋਂ ਆਪਣੀ ਹੈਗੇ ਨੇ ਸ਼ੁਰੂ ਇਹ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਸਰ ਬਾਕੀ ਸਮਝ ਆ ਗਈ ਮੈਨੂੰ ਡਾਈਟ ਕੋਈ ਗੱਲ ਨਹੀਂ ਬਾਕੀ ਜਦੋਂ ਆਊਂਗਾ ਇੱਕ ਦਿਨ ਪਹਿਲਾਂ ਆ ਜਾਵਾਂਗਾ ਠੀਕ ਹੈ ਸਰ ਓਕੇ ਠੀਕ ਹੈ ਸਰ ਓਕੇ ਜੀ ਓਕੇ ਧੰਨਵਾਦ ਸਰ ਓਕੇ ਜੀ ਓਕੇ